ਭੰਗੜਾ ਐਰੋਬਿਕਸ ਬਹੁਤ ਸਾਰੇ ਤਰੀਕਿਆਂ ਨਾਲ ਵਿਅਕਤੀਆਂ ਨੂੰ ਆਪਣੀਆਂ ਸੱਭਿਆਚਾਰਕ ਵਿਰਾਸਤ ਨੂੰ ਅਪਣਾਉਣ ਵਿੱਚ ਸ਼ਕਤੀ ਪ੍ਰਦਾਨ ਕਰਦਾ ਹੈ ਜਿਵੇਂ ਕਿ ਭੰਗੜਾ ਤੁਹਾਨੂੰ ਤੁਹਾਡੇ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਦਾ ਹੈ ਤੁਹਾਡੀ ਪੰਜਾਬੀਅਤ ਨਾਲ ਜੋੜ ਕੇ ਰੱਖਦਾ ਹੈ ਇਸ ਦੇ ਨਾਲ ਨਾਲ ਭੰਗੜਾ ਤੁਹਾਡੀ ਭੰਗੜਾ ਪਾਉਣ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਇਹ ਤੁਹਾਡਾ ਤਨਾਵ ਵੀ ਦੂਰ ਕਰਦਾ ਹੈ ਅਤੇ ਇਸ ਨੂੰ ਭੰਗੜਾ ਐਰੋਬਿਕਸ ਦੇ ਵਾਧੇ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਜਿਹੜੇ ਨੌਜਵਾਨ ਹਨ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਭੰਗੜੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਾਲ ਕਾਲਜਾਂ 'ਚ ਵੀ ਭੰਗੜਾ ਜ਼ਰੂਰ ਭੰਗੜੇ ਵਿੱਚ ਉਹਨਾਂ ਨੂੰ ਪਾਰਟੀਸੀਪੇਟ ਕਰਵਾਉਣਾ ਚਾਹੀਦਾ ਹੈ ਉਹਨਾਂ ਨੂੰ ਬਹੁਤ ਸਾਰੇ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਭੰਗੜਾ ਤੁਹਾਡੇ ਕਿਵੇਂ ਤੁਹਾਡੀ ਤੁਹਾਨੂੰ ਫਿਟ ਰੱਖਣ ਵਿੱਚ ਵੀ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਤੁਹਾਡੀ ਪੰਜਾਬੀਅਤ ਨਾਲ ਤੁਹਾਡੇ ਸੱਭਿਆਚਾਰ ਨਾਲ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖੇਗਾ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਵੀ ਉਹਦੇ ਲਈ ਪ੍ਰੇਰਿਤ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਭੰਗੜਾ ਐਰੋਬਿਕਸ ਬਹੁਤ ਸਾਰੇ ਤਰੀਕਿਆਂ ਨਾਲ ਵਿਅਕਤੀਆਂ ਨੂੰ ਉਹਨਾਂ ਦੀ ਸੱਭਿਆਚਾਰਿਕ ਬਿਆਨ ਵਿਰਾਸਤ ਨੂੰ ਅਪਣਾਉਣ ਲਈ ਸ਼ਕਤੀ ਪ੍ਰਦਾਨ ਕਰ ਸਕਦਾ ਹੈ